ਪੰਜਾਬੀ ਸਾਡੀ ਮਾਂ ਬੋਲੀ ਹੈ ਜੋ ਕਿ ਬਹੁਤ ਹੀ ਹਰਮਨ ਪਿਆਰੀ ਬੋਲੀ ਹੈ ਅਤੇ ਇਸ ਵਿੱਚ ਬੋਲਣਾ ਸਾਡੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਹੈ ਸੱਭਿਆਚਾਰ ਵਿੱਚ ਪੰਜਾਬੀ ਪਹਿਰਾਵਾ ਹੁੰਦਾ ਹੈ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਮਤਲਬ ਕਿ ਜਦੋਂ ਪੰਜਾਬੀ ਪਹਿਰਾਵਾ ਪੰਜਾਬੀ ਲੋਕ ਪਹਿ ਪਹਿ ਪੰਜਾਬੀ ਪਹਿਰਾਵਾ ਪਹਿਨਦੇ ਹਨ ਤਾਂ ਬਹੁਤ ਹੀ ਸੋਹਣਾ ਸੱਭਿਆਚਾਰ ਬਣ ਜਾਂਦਾ ਹੈ ਸਾਡੇ ਪਿਛਲੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਪੰਜਾਬੀ ਬੋਲੀ ਬੋਲਣਾ ਅਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਅਤੇ ਉਹਨੂੰ ਅ ਮਤਲਵ ਪੰਜਾਬੀ ਕਲਚਰ ਨੂੰ ਕਿੰਨਾ ਵਧੀਆ ਉਹ ਕਰਨਾ ਮਤਲਵ ਜਦੋਂ ਪੰਜਾਬੀ ਪਹਿਰਾਵਾ ਪਹਿਨਣਾ ਪੰਜਾਬੀ ਸੂਟ ਲਹਿੰਗਾ ਘੱਗਰੇ ਅਤੇ ਬੋਆਇਸ ਅ ਪਹਿਨਦੇ ਨੇ ਕੁੜਤਾ ਪਜਾਮਾ ਪੱਗ ਬੰਨਦੇ ਨੇ ਉਹ ਕਿੰਨਾ ਸੋਹਣਾ ਕਿੰਨੀ ਸੋਹਣੀ ਲੁਕ ਆਉਂਦੀ ਹੈ ਇਹਦੀ ਇਹ ਸਾਰਾ ਕੁਛ ਅਸੀਂ ਪੰਜਾਬੀ ਆਪਣੇ ਬਜ਼ੁਰਗਾਂ ਤੋਂ ਸਿੱਖਦੇ ਆ ਰਹੇ ਹਾਂ ਉਹਨਾਂ ਦੇ ਰੀਤੀ ਰਿਵਾਜ਼ ਨੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਰਹੇਹਾਂ ਅਤੇ ਮਤਲਬ ਗਿੱਧਾ ਭੰਗੜਾ ਕਿਵੇਂ ਪਾਉਣਾ ਮਤਲਬ ਕੀ ਕਰਨਾ ਰੀਤੀ ਰਿਵਾਜ਼ ਨੇ ਜਿਹੜੇ ਸਾਡੇ ਪੰਜਾਬੀਆਂ ਦੇ ਉਹਨਾਂ ਨੂੰ ਫੋਲੋ ਕਿਵੇਂ ਕਰਨਾ ਤਾਂ ਇਹ ਸਾਰਾ ਕੁਛ ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖਦੇ ਆ ਰਹੇ ਹਾਂ ਅਤੇ ਅੱਗੇ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਅਤੇ ਇਹ ਸੱਭਿਆਚਾਰ ਕਲਚਰ ਇੱਦਾਂ ਹੀ ਪ੍ਰਚਲਿਤ ਰਹਿਣਾ ਹੈ ਅਤੇ ਇਹਨਾਂ ਨੂੰ ਇਹ ਸੱਭਿਆਚਾਰ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਇਹ ਸਾਰੇ ਮਤਲਬ ਬਾਹਰੋਂ ਹੋਰ ਲੋਕ ਵੀ ਦੇਖ ਕੇ ਪੰਜਾਬੀਆਂ ਨੂੰ ਜ਼ਿਆਦਾ ਸੋਹਣਾ ਲੱਗਦੇ ਨੇ ਮੁੰਡਿਆਂ ਦੇ ਪੱਗਾਂ ਬੰਨੀਆਂ ਹੋਈਆਂ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ ਇੰਨਾ ਵਧੀਆ ਕਲਚਰ ਹੁੰਦਾ ਇੰਨਾ ਵਧੀਆ ਫੀਲ ਹੁੰਦਾ ਹੈ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬੀ ਹਾਂ